ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਸੂਟ ਹੈ ਹਾਂਜੀ ਪਲਾਜ਼ੋ ਵਾਸਤੇ ਕ ਪਲਾਜ਼ੋ ਕਿ ਸ਼ਰਾਰਾ ਸਵਾ ਕੀ ਬਣਵਾਉਣਾ ਹੈ ਹਾਂਜੀ ਮੈਮ ਕਿਸ ਤਰ੍ਹਾਂ ਕਿਹੜਾ ਕੱਪੜਾ ਹੈ ਸਿਲਕ ਹੈ ਕੋਟਨ ਹੈ ਗ੍ਰੇਸ ਕੋਟਨ ਹੈ ਲਾਈਨਿੰਗ ਲੱਗੇਗੀ ਲਾਉਣੀ ਹੈ ਕਿ ਨਹੀਂ ਸਿੰਪਲ ਸਵਾਉਣਾ ਹੈ ਕਿਸ ਤਰ੍ਹਾਂ ਦਾ ਸਵਾਉਣਾ ਹੈ ਸਿਲਕ ਹੈ ਤਾਂ ਫਿਰ ਫੁੱਲ ਲਾਈਨਿੰਗ ਲੱਗੇਗੀ ਹਾਂਜੀ ਅੱਗੇ ਲਾਸਟਿਕ ਪਿੱਛੇ ਲਾਸਟਿਕ ਅੱਗੇ ਬੈਲਟ ਲਗਵਾਉਣੀ ਹੈ ਕਿ ਫੁੱਲ ਲਾਸਟਿਕ ਬਣਵਾਉਣਾ ਹੈ ਅੱਛਾ ਪੋਕਿਟ ਰੱਖੋਗੇ ਪੋਂਚ ਠੀਕ ਹੈ ਜੀ ਠੀਕ ਹੈ ਪੋਂਚਾ ਕਿੰਨਾ ਰੱਖਣਾ ਹੈ ਠੀਕ ਹੈ ਜੀ ਠੀਕ ਹੈ ਓਕੇ ਸ਼ਰਟ ਕਿਸ ਤਰ੍ਹਾਂ ਸ਼ਰਟ ਦਾ ਕੀ ਕਰਨਾ ਹੈ ਕਿਸ ਤਰ੍ਹਾਂ ਬਣਾਉਣੀ ਹੈ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਪਾਈਪਿੰਗ ਪਸੰਦ ਕਰੋਂਗੇ ਸਿੰਪਲ ਕਿ ਡਿਜ਼ਾਈਨਿੰਗ ਵਾਲੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕੋਈ ਨਾ ਜੀ ਹੋਰ ਤੇ ਤਾਂ ਨਹੀਂ ਕੋਈ ਡਿਜ਼ਾਈਨ ਵਗੈਰਾ ਬਣਵਾਉਣਾ ਮੋਟੇ ਗਲੇ 'ਤੇ ਠੀਕ ਹੈ ਜੀ ਮੈਮ ਪਾਈਪਿੰਗ ਤੁਸੀਂ ਲਾਈਨਿੰਗ ਤੁਸੀਂ ਘਰੋਂ ਆਪ ਦਿਓਗੇ ਕਿ ਅਸੀਂ ਪ੍ਰੋਵਾਈਡ ਕਰਾਂਗੇ ਜੇ ਅਸੀਂ ਪ੍ਰੋਵਾਈਡ ਕਰਾਂਗੇ ਤੇ ਅੱਠ ਸੌ ਰੁਪਈਆ ਸਿਲਾਈ ਲੱਗੇਗੀ ਵਿੱਚੇ ਲਾਈਨਿੰਗ ਵਿੱਚੇ ਪਾਈਪਿੰਗ ਵਿੱਚੇ ਸਿਲਾਈ ਸਾਰਾ ਕੁਛ ਪਾ ਕੇ ਇੰਟਰਲੋਕ ਕਰਕੇ ਦੇਵਾਂਗੇ ਕਿੰਨੀ ਤਰੀਕ ਨੂੰ ਚਾਹੀਦਾ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਮੈੇਮ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਤੁਸੀਂ ਜਦੋਂ ਮਰਜ਼ੀ ਆ ਜਾਓ ਠੀਕ ਹੈ ਜੀ ਓਕੇ ਓਕੇ